ਜੇਕਰ ਸਾਡੇ ਪਿੰਡ ਵਿੱਚ ਕੋਈ ਵਿਅਕਤੀ ਕਿਸੇ ਮੰਗ ਕਿਸੇ ਜਾਵੇ ਤਾਂ ਅਸੀਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਘਰ ਵਿੱਚ ਲਿਆ ਕੇ ਉਸ 'ਤੇ ਗਰਮ ਕੱਪੜੇ ਨਾਲ ਟਕੋਰ ਕਰਾਂਗੇ ਅਤੇ ਉਸਨੂੰ ਗਰਮ ਦੁੱਧ ਵਿੱਚ ਹਲਦੀ ਪਾ ਕੇ ਉਸਨੂੰ ਇੱਕ ਵਾਰ ਦਰਦ ਘੱਟ ਕਰਨ ਦੀ ਪ੍ਰਕਿਰਿਆ ਕਰਾਂਗੇ ਉਸਦੇ ਉਪਰੰਤ ਉਸ ਵਿਅਕਤੀ ਦੇ ਪੱਟੀ ਬੰਨ੍ਹ ਕੇ ਉਸਦੇ ਕੋਈ ਮੱਲ੍ਹਮ ਜਿਵੇਂ ਹਲਦੀ ਦਾ ਲੇਪ ਧਾਰਨ ਕਰਕੇ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਂਗੇ ਜੋ ਕਿ ਹੱਡੀਆਂ ਟੁੱਟੇ ਨੂੰ ਸਹੀ ਕਰਨ ਜਾਂ ਓਪਰ ਓਪਰੇਟਿਵ ਹਸਪਤਾਲ ਹੋਵੇ ਉਸ ਵਿੱਚ ਭਰਤੀ ਕਰਾਂਗੇ ਉਸਨੂੰ ਟੁੱਟੇ ਅੰਗ ਨੂੰ ਰੀਕਵਰ ਕਰਨ ਲਈ ਡਾਕਟਰ ਨੂੰ ਪਲਸਤਰ ਦੀ ਮੰਗ ਕਰਾਂਗੇ ਅਤੇ ਕੋਈ ਵਧੀਆ ਐਂਟੀਬੈਟਿਕ ਦਵਾਈਆਂ ਅਤੇ ਦਵਾਈਆਂ ਵਧੀਆ ਰੀਕਵਰ ਕਰਨ ਲਈ ਅੰਗ ਨੂੰ ਰੈਸਟ ਮਿਲੇ ਉਸ ਨੂੰ ਵਧੀਆ ਪਲਸਤਰ ਕਰਨ ਦੀ ਮੰਗ ਕਰਾਂਗੇ